ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਅਸੀਂ ਆਪਣੇ ਘਰ ਵਿੱਚ ਹੀ ਕਿਚਨ ਗਾਰਡਨਗ ਕਰਦੇ ਹਾਂ ਔਰ ਅਸੀਂ ਆਪਣੇ ਘਰ ਵਿੱਚ ਹੀ ਗਮਲਿਆਂ ਵਿੱਚ ਫੁੱਲ ਵਗੈਰਾ ਸਬਜ਼ੀਆਂ ਵਗੈਰਾ ਲਗਾਈਆਂ ਹੋਈਆਂ ਨੇ ਔਰ ਜਿਸ ਤਰ੍ਹਾਂ ਕਿ ਮਈ ਮਹੀਨੇ ਤੋਂ ਅਸੀਂ ਵੇਲ੍ਹਾਂ ਵਗੈਰਾ ਬੀਜ ਬੀਜ ਦਿੱਤੇ ਸੀ ਔਰ ਉਹਨਾਂ ਜੂਨ ਮਹੀਨੇ ਦੇ ਵਿੱਚ ਉਹ ਸ਼ੁਰੂ ਹੋ ਗਏ ਲੱਗਣੀਆਂ ਵੇਲ੍ਹਾਂ ਸ਼ੁਰੂ ਹੋ ਗਈਆਂ ਸਬਜ਼ੀਆਂ ਜਿਸ ਤਰ੍ਹਾਂ ਤੋਰੀਆਂ ਦੀਆਂ ਵੇਲ੍ਹਾਂ ਔਰ ਬੈਂਗਣ ਜਿਸ ਤਰ੍ਹਾਂ ਬੈਂਗਣ ਦੇ ਬੂਟੇ ਟਮਾਟਰ ਦੇ ਬੂਟੇ ਸਭ ਲਗਾਏ ਹੋਏ ਨੇ ਇਹਨਾਂ ਵੀ ਤੁਸੀਂ ਕਦੀ ਵੀ ਬਾਹਰੋਂ ਖਾਦ ਲਿਆ ਕੇ ਕੀਟਨਾਸ਼ਕ ਖਾਦ ਖਾਦ ਨਹੀਂ ਲ ਪਾਈ ਇਸ ਕਰਕੇ ਅਸੀਂ ਘਰ ਦੀਆ ਸਬਜ਼ੀਆਂ ਜਿਸ ਤਰ੍ਹਾਂ ਆਲੂਆਂ ਦਾ ਸੀਕਰ ਪਿਆਜ਼ ਦਾ ਸੀਕਰ ਲਸਣ ਦੇ ਸੀਕਰ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਪਾਣੀ ਵਿੱਚ ਭਿਓਂ ਕੇ ਰੱਖ ਦਿੰਦੇ ਹਾਂ ਔਰ ਇਹੀ ਅਸੀਂ ਆਪਣੀ ਗਮਲਿਆਂ ਵਿੱਚ ਪਾਉਂਦੇ ਹਾਂ ਜਿਹਦੇ ਨਾਲ ਸਾਡੀ ਬਹੁਤ ਵਧੀਆ ਸਬਜ਼ੀਆਂ ਹੋਈਆਂ ਨੇ ਉਹਨਾਂ ਦੀ ਪੈਦਾਵਾਰ ਬਹੁਤ ਵਧੀਆ ਆ ਅਸੀਂ ਉਹੀ ਘਰ ਵਿੱਚ ਖਾਂਦੇ ਹਾਂ ਕਦੀ ਬਾਜ਼ਾਰੋਂ ਸਬਜ਼ੀ ਲਿਆ ਕੇ ਨਹੀਂ ਔਰ ਇਸੇ ਤਰ੍ਹਾਂ ਅਸੀਂ ਫਲਾਵਰ ਵੀ ਬਹੁਤ ਵਧੀਆ ਆਪਣੇ ਘਰ ਵਿੱਚ ਛੱਤ 'ਤੇ ਲਗਾਏ ਹੋਏ ਨੇ ਬਹੁਤ ਵਧੀਆ ਸਵੇਰੇ ਅਸੀਂ ਜਾਂਦੇ ਹਾਂ ਕੋਠੇ 'ਤੇ ਅਤੇ ਅਸੀਂ ਆਪਣੇ ਬਗੀਚੇ ਵਿੱਚ ਜਾਂਦੇ ਹਾਂ ਬਹੁਤ ਵਧੀਆ ਲੱਗਦਾ ਓਕੇ ਥੈਂਕ ਯੂ